ਹਾਂ ਤੁਸੀਂ ਬੁਣਾਈ ਕਰਦੇ ਸਮੇਂ ਧਾਗੇ ਦੇ ਰੰਗ ਦੀ ਚੋਣ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਤੁਹਾਡੀ ਪਸੰਦ ਮੌਕੇ ਦਾ ਮਹੱਤਵ ਜਾਂ ਕਿਸੇ ਖਾਸ ਡਿਜ਼ਾਈਨ ਨੂੰ ਧਿਆਨ ਵਿੱਚ ਰੱਖ ਕੇ ਰੰਗ ਚੁਣੇ ਜਾ ਸਕਦੇ ਹਨ ਕੁਛ ਅਹਿਮ ਗੱਲਾਂ ਜੋ ਧਿਆਨ ਦੀ ਚੋਣ ਕਰਦੇ ਸਮੇਂ ਆਪਾਂ ਧਿਆਨ ਦੇ ਵਿੱਚ ਰੱਖ ਸਕਦੇ ਹਾਂ ਜਿਵੇਂ ਕਿ ਮੌਸਮ ਅਤੇ ਮੌਸਮ ਅਨੁਸਾਰ ਰੰਗ ਆਪਾਂ ਸੇ ਧਿਆਨ ਨਾਲ ਧਿਆਨ 'ਚ ਰੱਖੀਏ ਰੰਗਾਂ ਦੇ ਸੰਜੋਗ ਨੂੰ ਧਿਆਨ 'ਚ ਰੱਖੀਏ ਜੇਕਰ ਤੁਸੀਂ ਮਲਟੀਕਲਰ ਡਿਜ਼ਾਇਨ ਚਾਹੁੰਦੇ ਹੋ ਤਾਂ ਕੰਟਰਾਸਟ ਅਤੇ ਹਾਰਮਨੀ ਵਾਲੇ ਰੰਗਾਂ ਦੀ ਚੋਣ ਕਰੋ ਜਿਵੇਂ ਕਿ ਨੀਲਾ ਅਤੇ ਸੰਤਰੀ ਜਾਂ ਪੇਸਟਲ ਰੰਗ ਮਿਲਾ ਕੇ ਸੋਫਟ ਲੁੱਕ ਦੇ ਸਕਦੇ ਹੋ ਆਪਣੀ ਪਸੰਦ ਦੇ ਵਿਅਕਤੀਤਵ ਅੰਦਾਜ਼ ਦੇ ਹਿਸਾਬ ਨਾਲ ਤੁਸੀਂ ਰੰਗਾਂ ਦੀ ਚੋਣ ਕਰੋ ਕਈ ਵਾਰ ਕੋਈ ਖਾਸ ਰੰਗ ਤੁਹਾਡੀ ਸ਼ਖਸੀਅਤ ਜਾਂ ਮੁੜ ਨੂੰ ਦਰਸਾਉਂਦੇ ਹਨ ਜੇਕਰ ਤੁਸੀਂ ਨਿਰਮਲ ਅਤੇ ਸ਼ਾਂਤ ਲੁਕ ਜਾਂਦੇ ਹੋ ਤਾਂ ਨਰਮ ਰੰਗ ਵਰਤੋ ਜੇਕਰ ਤੁਸੀਂ ਉਤਸ਼ਾਹ ਭਰਿਆ ਡਿਜ਼ਾਈਨ ਚਾਹੁੰਦੇ ਹੋ ਤਾਂ ਚਟਾਕੇਦਾਰ ਅਤੇ ਗਹਿਰੇ ਰੰਗ ਚੁਣੋ ਪੈਟਰਨ ਦੇ ਡਿਜ਼ਾਇਨ ਜੇਕਰ ਤੁਸੀਂ ਕੋਈ ਖਾਸ ਪੈਟਰਲ ਬੁਣ ਰਹੇ ਹੋ ਤਾਂ ਉਸਨੂੰ ਉਭਾਰਨ ਲਈ ਉਚਿਤ ਰੰਗ ਚੁਣੋ ਉਦਾਹਰਣ ਲਈ ਧਾਰੀਦਾਰ ਪੈਟਰਨ ਵਿੱਚ ਜੋ ਦੋ ਤਿੰਨ ਵੱਖ ਵੱਖ ਰੰਗ ਚਲਦੇ ਹਨ ਉਹਨਾਂ ਦੇ ਧਿਆਨ 'ਤੇ ਚੰਗੇ ਲੱਗਦੇ ਹੋਏ ਰੰਗ ਲੱਭੋ ਵਿਸ਼ੇਸ਼ ਮੌਕੇ ਜੇਕਰ ਤੁਸੀਂ ਕਿਸੇ ਤਿਉਹਾਰ ਜਾਂ ਖਾਸ ਸਮਾਗਮ ਲਈ ਬੁਣਾਈ ਕਰ ਰਹੇ ਹੋ ਤਾਂ ਉਸ ਮੌਕੇ ਨਾਲ ਮਿਲਦੇ ਜੁਲਦੇ ਰੰਗ ਚੁਣੋ ਜਿਵੇਂ ਕਿ ਜੇ ਵਿਆਹ ਹੈ ਤਾਂ ਤੁਸੀਂ ਵਿਆਹ ਦੇ ਹਿਸਾਬ ਨਾਲ ਲਾਲ ਰੰਗ ਬਰਾਈਡ ਦੇ ਲਈ ਰੱਖੋ